ਹਾਂ ਮੈਨੂੰ ਟੈਕਨੋਲਜੀ ਨਵੀਂ ਟੈਕਨੋਲਜੀ ਸਮਝਣ ਲਈ ਬਹੁਤ ਮੁਸ਼ਕਲ ਆਈ ਹੈ ਇਸ ਤਰ੍ਹਾਂ ਹੈ ਕਿ ਪਹਿਲੇ ਚਿੱਠੀਆਂ ਪਾਉਂਦੇ ਸੀਗੇ ਅਤੇ ਛੇ ਛੇ ਛੇ ਛੇ ਦਿਨ ਚਿੱਠੀਆਂ ਲਿਖਣੀਆਂ ਪਹੁੰਚਣੇ ਨੂੰ ਟਾਈਮ ਲੱਗ ਜਾਣਾ ਆਪਣੇ ਮਨ ਦੀਆਂ ਗੱਲਾਂ ਦੂਜੇ ਤੱਕ ਪਹੁੰਚਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਤਾ ਹੁਣ ਨਵੀਂ ਟੈਕਨੋਲਜੀ ਇਹ ਆ ਗਈ ਕਿ ਹੁਣ ਫੋਨ ਰਾ ਅਸੀਂ ਇੱਕ ਸਕਿੰਟ ਵਿੱਚ ਹੀ ਫੋਨ ਮਿਲਾਓ ਅਤੇ ਗੱਲ ਕਰ ਲਓ ਅਤੇ ਬਾਕੀ ਇਹ ਗੱਲ ਹੈਗੀ ਹੈ ਕਿ ਨਵੀਂ ਟੈਕਨੋਲਜੀ ਇਹ ਸਾਨ ਮੈਨੂੰ ਸਮਝਣ ਵਿੱਚ ਬਹੁਤ ਔਖੀ ਆਈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਵਟਸਐਪ ਚਲਾਉਂਦੇ ਹੋ ਫੇਸਬੁਕ ਚਲਾਉਂਦੇ ਇੰਸਟਾਗਰਾਮ ਚਲਾਉਂਦੇ ਮੈਨੂੰ ਇਹ ਸਮਝਣ ਵਿੱਚ ਬਹੁਤ ਔਖੀ ਮਹਿਸੂਸ ਹੋਈ ਮੈਂ ਇਹ ਵ ਇਸ ਟਾਈਮ 'ਤੇ ਆਪਣੇ ਬੱਚਿਆਂ ਦੀ ਸਹਾਇਤਾ ਲਈ ਮੇਰੇ ਬੱਚਿਆਂ ਨੇ ਮੈਨੂੰ ਵਟਸਐਪ 'ਤੇ ਆਈ ਡੀ ਬਣਾਉਣਾ ਸਿਖਾਇਆ ਅਤੇ ਵਟਸਐਪ 'ਤੇ ਮੈਨੂੰ ਮੈਸੇਜ ਲਿਖਣੇ ਸਿਖਾਏ ਮੈਨੂੰ ਤਾਂ ਬਹੁਤ ਔਖੀ ਲੱਗਦੀ ਮੈਂ ਇੱਕ ਇੱਕ ਅਕਸ਼ਰ ਦੇਖ ਦੇਖ ਕੇ ਬੜੀ ਮੁਸ਼ਕਲ ਨਾਲ ਲਿਖ ਪਾਉਂਦੀ ਸੀ ਇੱਕ ਇੱਕ ਸ਼ਬਦ ਨੂੰ ਇੱਕ ਇੱਕ ਸੈਨਟੈਂਨਸ ਨੂੰ ਮੈਂ ਲਿਖਣ ਲਈ ਦੋ ਦੋ ਮਿੰਟ ਲਾ ਦਿੰਦੇ ਦਿੰਦੀ ਸੀਗੀ ਬੱਚੇ ਝੱਟ ਪੱਟ ਲਿਖ ਲੈਂਦੇ ਬੱਚਿਆਂ ਨੇ ਮੈਨੂੰ ਬੜੇ ਪਿਆਰ ਨਾਲ ਬਹੁਤ ਅੱਛੇ ਢੰਗ ਨਾਲ ਸਿਖਾਇਆ ਕਿ ਮੰਮਾ ਤੁਸੀਂ ਐਦਾਂ ਕਰੋ ਐਦਾਂ ਕਰੋ ਐਦਾਂ ਕਰੋ ਐਦਾਂ ਲਿਖੋ ਅਤੇ ਮੈਨੂੰ ਆਪਣੇ ਫੋਨ ਦੀ ਆਈ ਡੀ ਵੀ ਫੇਸਬੁੱਕ ਦੀ ਵੀ ਇੰਟਾਗਰਾਮ 'ਤੇ ਅਤੇ ਵਟਸਐਪ ਦੀ ਵੀ ਸਾਰਾ ਕੁਛ ਬਣਾਉਣਾ ਸਿਖਾ ਦਿੱਤਾ ਧੰਨਵਾਦ